ਜੀ ਹਾਂਜੀ ਜਿਹੜਾ ਇਹ ਧਰਮ ਹੈ ਸਾਡੇ ਸਕੂਲ ਵਿੱਚ ਸਾਡੇ ਪਾਠਕ੍ਰਮ ਦਾ ਹਿੱਸਾ ਰਿਹਾ ਕਿਉਂਕਿ ਇਸ ਪਾਠ ਰਾਹੀਂ ਪਾਠਕ੍ਰਮ ਰਾਹੀਂ ਸਾਨੂੰ ਆਪਣੇ ਗੁਰੂਆਂ ਬਾਰੇ ਪਤਾ ਚਲਦਾ ਹੈਗਾ ਵੀ ਸਾਡੇ ਗੁਰੂਆਂ ਨੇ ਸਾਡੇ ਬਾਰੇ ਕੀ ਕੀ ਕੁਰਬਾਨੀਆਂ ਕੀਤੀਆਂ ਜਾਂ ਕੀ ਕੀ ਲੜਾਈਆਂ ਲੜੀਆਂ ਉਹਨਾਂ ਨੇ ਆਪਣੇ ਧਰਮ ਬਾਰੇ ਅਤੇ ਜਦੋਂ ਅਸੀਂ ਸਕੂਲ ਦੇ ਵਿੱਚ ਐਂਟਰ ਕਰਦੇ ਹਾਂ ਸੁਬਹਾ ਜਦੋਂ ਪ੍ਰਾਰਥਨਾ ਹੁੰਦੀ ਹੈ ਤਾਂ ਸਾਨੂੰ ਸਾਡੇ ਧਰਮ ਬਾਰੇ ਗੁਰਬਾਣੀ ਕਰਵਾਈ ਜਾਂਦੀ ਹੈ ਕਿ ਤਾਂ ਕਿ ਅਸੀਂ ਕਿਸੇ ਗਲਤ ਕੰਮ ਵੱਲ ਨਾ ਜਾਈਏ ਸਿਰਫ ਗੁਰਬਾਣੀ ਵੱਲ ਧਿਆਨ ਰੱਖੀਏ ਅਤੇ ਇਹ ਇੱਕ ਸਾਡੇ ਜੀਵਨ ਦਾ ਹਿੱਸਾ ਰਹੀ ਸਾਨੂੰ ਇਸ ਤੋਂ ਬਹੁਤ ਸੇਧ ਮਿਲਦੀ ਹੈਗੀ ਅਤੇ ਇਹਦੇ ਨਾਲ ਸਾਡੇ ਪੁਰਖਿਆਂ ਬਾਰੇ ਸਾਨੂੰ ਪਤਾ ਲੱਗਦਾ ਵੀ ਸਾਡੇ ਗੁਰੂਆਂ ਨੇ ਸਾਡੇ ਬਾਰੇ ਕੀ ਕੀ ਕੁਰਬਾਨੀਆਂ ਕੀਤੀਆਂ ਕਿਵੇਂ ਉਹਨਾਂ ਨੇ ਆਪਣੇ ਪਰਿਵਾਰ ਵਾਰੇ ਕਿਵੇਂ ਉਹਨਾਂ ਨੇ ਦੂਜੇ ਧਰਮਾਂ ਦੀ ਵੀ ਸਹਾਇਤਾ ਕੀਤੀ ਗੁਰੂਆਂ ਨੇ ਅਤੇ ਉਹ ਆਪਣੇ ਧਰਮ ਲਈ ਕਿਵੇਂ ਲੜੇ ਅਤੇ ਇਹ ਜਿਹੜਾ ਇਸ ਇਹਦਾ ਜੀਵ ਇਹਦਾ ਸਾਡੇ ਜੀਵਨ ਵਿੱਚ ਬਹੁਤ ਪ੍ਰਭਾਵ ਪੈਂਦਾ ਹੈਗਾ ਇਹਦੇ ਨਾਲ ਇੱਕ ਸਾਡੀ ਵੱਖਰੀ ਪਹਿਚਾਣ ਹੁੰਦੀ ਹੈ ਇਹਦੇ ਨਾਲ ਸਾਨੂੰ ਇੱਕ ਨੇਕ ਕੰਮ ਕਰਨ ਦੀ ਸਿੱਖਿਆ ਮਿਲਦੀ ਹੈ ਧਰਮ ਨਾਲ ਅਤੇ ਇਹਦੇ ਨਾਲ ਸਾਨੂੰ ਗਰੀਬਾਂ ਦੀ ਸਹਾਇਤਾ ਲੋੜਵੰਦਾਂ ਦੀ ਸਹਾਇਤਾ ਕਰਨ ਨਾਲ ਵੀ ਆਗਿਆ ਮਿਲਦੀ ਹੈ ਅਤੇ ਇਹ ਧਰਮ ਹੈ ਜਿਹੜਾ ਸਾਡਾ ਸਾਨੂੰ ਇੱਕ ਸੱਚ ਦੇ ਰਾਹ 'ਤੇ ਤੋਰਦਾ ਹੈਗਾ ਅਤੇ ਇਹ ਸਾਨੂੰ ਬੁਰੇ ਕੰਮਾਂ ਤੋਂ ਦੂਰ ਰੱਖਦਾ ਹੈਗਾ ਇਹਦੇ ਨਾਲ ਸਾਨੂੰ ਦੂਜਿਆਂ ਦੀ ਸਹਾਇਤਾ ਕਰਨ ਦੀ ਵੀ ਇੱਕ ਸੇਧ ਮਿਲਦੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਅਸੀਂ ਕੋਈ ਰੋਟੀ ਰਾਹੀਂ ਕੋਈ ਲੀੜੇ ਕੱਪੜੇ ਰਾਹੀਂ ਕੋਈ ਜਿਸ ਤਰ੍ਹਾਂ ਦੀ ਵੀ ਸਾਡੀ ਆਪਦੀ ਗੁੰਜਾਇਸ਼ ਹੈ ਅਸੀਂ ਸਹਾਇਤਾ ਕਰ ਸਕੀਏ ਅਤੇ ਇਹ ਸਾਨੂੰ ਦੂਜਿਆਂ ਦੇ ਨਾਲੋਂ ਇੱਕ ਤਰ੍ਹਾਂ ਇਹ ਵੱਖਰਾ ਕਰਦਾ ਹੈਗਾ ਅਤੇ ਇਹ ਸਾਡੀ ਇੱਕ ਵੱਖਰੀ ਪਹਿਚਾਣ ਆ